ਸਾਡੇ ਪਿੰਡ ਦੇ ਨੌਜਵਾਨ ਰੁਜ਼ਗਾਰ ਦਾ ਪ੍ਰਸਿੱਧ ਸਥਾਨ ਟਰਾਈਡੇਟ ਕੌਂਪਨੀ ਹੈ ਇਸ ਕੰਪਨੀ ਵਿੱਚ ਕੰਮ ਕਰਨ ਜਾਂਦੇ ਹਨ ਇਹ ਧੌਲਾ ਪਿੰਡ ਵਿਖੇ ਲੱਗੀ ਹੋਈ ਹੈ ਇਸ ਵਿੱਚ ਕੰਮ ਕਰਨ ਵਾਲੇ ਜ਼ਿਆਦਾਤਰ ਲੋਕ ਪ੍ਰਵਾਸੀ ਹਨ ਜੋ ਭਾਰਤ ਦੇ ਵੱਖ ਵੱਖ ਸਟ ਸਟੇਟਾਂ ਤੋਂ ਆ ਕੇ ਇੱਥੇ ਰਹਿੰਦੇ ਹਨ ਜੋ ਕਿ ਜ਼ਿਆਦਾਤਰ ਹੰਢਾਇਆ ਅਤੇ ਬਰਨਾਲਾ ਵਿਖੇ ਰਹਿੰਦੇ ਹਨ ਇਸ ਕੰਪਨੀ ਵਿੱਚ ਆਸੇ ਪਾਸੇ ਪਿੰਡਾਂ ਤੋਂ ਵੀ ਆ ਕੇ ਨੌਜਵਾਨ ਕੰਮ ਕਰਦੇ ਹਨ ਆਮ ਤੌਰ 'ਤੇ ਉਹ ਵੀ ਹੰਢਾਇਆ ਅਤੇ ਬਰਨਾਲਾ ਵਿਖੇ ਹੀ ਰਹਿੰਦੇ ਹਨ ਆਮ ਤੌਰ 'ਤੇ ਇੱਥੇ ਛੋਟੇ ਵਰਕਰ ਤੋਂ ਸਫਾਈ ਸੇਵਕ ਕਾਰਪੈਂਟਰ ਡਰਾਈਵਰ ਲੇਵਰ ਮੈਨੇਜਰ ਤੱਕ ਵੀ ਨੌਜਵਾਨ ਲੱਗ ਕੇ ਕੰਮ ਕਰ ਰਹੇ ਹਨ ਇਹ ਕੰਪਨੀ ਦੀਆਂ ਵੱਡੀਆਂ ਤਿੰਨ ਬਰਾਂਚਾਂ ਹਨ ਜਿਸ ਵਿੱਚ ਤੌਲੀਆ ਧਾਗਾ ਅਤੇ ਮੈਡੀਸਨ ਬਣਦੀ ਹੈ ਇਸ ਕੰਪਨੀ ਨੇ ਹੋਰ ਵੀ ਕਈ ਤਰ੍ਹਾਂ ਦੇ ਰੁਜ਼ਗਾਰ ਪੈਦਾ ਕਰ ਦਿੱਤੇ ਹਨ ਜਿਵੇਂ ਲੋਕ ਆਪਣੇ ਘਰਾਂ ਵਿੱਚ ਕਿਰਾਏ 'ਤੇ ਇਹਨਾਂ ਕੌਂਪਨੀ ਵਿੱਚ ਕੰਮ ਕਰਦੇ ਮੁਲਾਜ਼ਮਾਂ ਲਈ ਕਿਰਾਏ 'ਤੇ ਮਕਾਨ ਦਿੰਦੇ ਹਨ ਅਤੇ ਜਿਹਨਾਂ ਤੋਂ ਉਹਨਾਂ ਨੂੰ ਆਮਦਨ ਵੱਧ ਜਾਂਦੀ ਹੈ ਅਤੇ ਕਈ ਤਾਂ ਲੋਕਾਂ ਨੇ ਆਪਣੇ ਘਰਾਂ ਨੂੰ ਪੀ ਜੀ ਬਣਾ ਕੇ ਰੱਖਿਆ ਹੋਇਆ ਹੈ ਜਿਸ ਵਿੱਚ ਕੰਮ ਕਰਦੇ ਨੌਜਵਾਨ ਉੱਥੇ ਰਹਿਣ ਦੇ ਨਾਲ ਨਾਲ ਉਸ ਨੂੰ ਖਾਣਾ ਵੀ ਮਿਲਦਾ ਹੈ ਅਤੇ ਉਹ ਆਪਣੇ ਟਾਈਮ 'ਤੇ ਜਾ ਸਕਦੇ ਹਨ ਇਸ ਤਰ੍ਹਾਂ ਇਹ ਕੰਪਨੀ ਇੱਕ ਬਹੁਤ ਵੱਡਾ ਰੁਜ਼ਗਾਰ ਮੁਹੱਈਆ ਬਰਨਾਲੇ ਜ਼ਿਲ੍ਹੇ ਵਿੱਚ ਕਰਵਾ ਰਹੀ ਹੈ ਅਤੇ ਆਸੇ ਪਾਸੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਵਿੱਚ ਲਗਾ ਰਹੀ ਹੈ